ਬਾਰਾਂ ਅਗਸਤ ਉੱਨੀ ਸੌ ਬਾਨਵੇਂ ਨੌਂ ਜੂਨ ਉੱਨੀ ਸੌ ਸਤਾਨਵੇਂ ਇਕ ਜਨਵਰੀ ਦੋ ਹਜ਼ਾਰ ਨੌਂ ਸਤੰਬਰ ਉੱਨੀ ਸੌ ਪੈਂਹਠ ਗਿਆਰਾਂ ਅਕਤੂਬਰ ਉੱਨੀ ਸੌ ਬਾਹਠ